ਪੰਜਾਬ ਦਾ ਸੱਭਿਆਚਾਰ ਭਾਰਤ ਤੋਂ ਬਹੁਤ ਹੀ ਅਲੱਗ ਹੈ ਪੰਜਾਬ ਦੇ ਅਸੀਂ ਦੇਖਦੇ ਹਾਂ ਇੱਥੇ ਮੇਲੇ ਅਤੇ ਪੰਜਾਬ ਦੇ ਗੱਭਰੂ ਔਰ ਮੁਟਿਆਰਾਂ ਬਹੁਤ ਹੀ ਅਲੱਗ ਤਰ੍ਹਾਂ ਤੋਂ ਪਛਾਣ ਹੋ ਜਾਂਦੇ ਹਨ ਜਿਵੇਂ ਇੱਥੇ ਪੰਜਾਬ ਦੇ ਮੁਟਿਆਰਾਂ ਪੰਜਾਬੀ ਸੂਟ ਸਲਵਾਰ ਸੂਟ ਅਤੇ ਜਿਹੜੇ ਗੱਭਰੂ ਹਨ ਉਹ ਕੁੜਤਾ ਚਾਦਰਾ ਲਾਉਂਦੇ ਹਨ ਅਤੇ ਇਹ ਸਾਰੇ ਕਿਤੇ ਇਹਨਾਂ ਦੇ ਪਹਿਰਾਵਾ ਮਸ਼ਹੂਰ ਹੈ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਮਸ਼ਹੂਰ ਹੈ ਇਹਨਾਂ ਦਾ ਪਹਿਰਾਵਾ ਸੱਭਿਆਚਾਰਕ ਨੂੰ ਲੈ ਕੇ ਅਸੀਂ ਜੇ ਦੇਖਿਆ ਜਾਵੇ ਤਾਂ ਇਹਨਾਂ ਵਿੱਚ ਗਿੱਧਾ ਭੰਗੜਾ ਇਹ ਸਭ ਕਿਤੇ ਮਸ਼ਹੂਰ ਆ ਔਰ ਜਿਹੜੀ ਅਸੀਂ ਐਜੂਕੇਸ਼ਨ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਦੇਖਿਆ ਜਾਵੇ ਤਾਂ ਹਰੇਕ ਮੰਦਰ ਗੁਰਦੁਆਰਾ ਔਰ ਮਸੀਤ ਦੇ ਨਾਲ ਇੱਕ ਸਕੂਲ ਜ਼ਰੂਰ ਹੁੰਦਾ ਸੀ ਜਿਹੜਾ ਕਿ ਅੱਜ ਕੱਲ੍ਹ ਇਹ ਚੀਜ਼ ਖਤਮ ਕਰ ਦਿੱਤੀ ਹੈ ਉਸ ਵੇਲੇ ਸਾਡੀ ਸਟੱਡੀ ਬਹੁਤ ਮਜ਼ਬੂਤ ਹੁੰਦੀ ਸੀ ਹਰੇਕ ਤ ਪਾਸਿਓਂ ਉਹ ਬੱਚੇ ਪੜ੍ਹਦੇ ਹੁੰਦੇ ਸੀ ਹੁਣ ਜਿਹੜਾ ਕੀ ਹੈ ਸਾਡੇ ਬੱਚੇ ਬਾਹਰ ਵੱਲ ਨੂੰ ਜਾ ਰਹੇ ਹਨ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ ਔਰ ਸਾਡਾ ਜਿਹੜਾ ਸੱਭਿਆਚਾਰ ਆ ਉਹ ਇੱਥੇ ਖਤਮ ਹੁੰਦਾ ਜਾ ਰਿਹਾ ਹੈ